ਸਾਡੇ ਖੇਤਰ ਵਿੱਚ ਅਸੀਂ ਮੈਂ ਲੁਧਿਆਨਾ ਤੋਂ ਹੈਗੀ ਹਾਂ ਤੇ ਸਾਡੇ ਖੇਤਰ ਵਿੱਚ ਅਸੀਂ ਇੱਕ ਬੰਦੇ ਨੂੰ ਕੰਮ ਕਰਦੇ ਦੇਖਿਆ ਸਭ ਤੋਂ ਪਹਿਲਾਂ ਉਹਨੇ ਜਿਹੜਾ ਕਾਰੋਬਾਰ ਹੈ ਉਹ ਸਾਈਕਲ ਦੇ ਪੈਡਲ ਜਿਹੜੇ ਪਈਏ ਹੁੰਦੇ ਹੈ ਉਹਦਾ ਕੰਮ ਸ਼ੁਰੂ ਕੀਤਾ ਤੇ ਪੈਡਲ ਤੋਂ ਕੰਮ ਸ਼ੁਰੂ ਕਰਦੇ ਕਰਦੇ ਉਸ ਬੰਦੇ ਨੇ ਇਸ ਤੋਂ ਬਾਦ ਸਾਈਕਲ ਦੀਆਂ ਸੀਟਾਂ ਬਨੋਣੀਆਂ ਸ਼ੁਰੂ ਕਰਤੀਆਂ ਜਦ ਉਸਨੂੰ ਲੱਗਿਆ ਕੇ ਉਹਦਾ ਜਿਹੜਾ ਕਾਰੋਬਾਰ ਹੈ ਉਹ ਵਧਦਾ ਪਿਆ ਹੈ ਉਸ ਕਾਰੋਬਾਰ ਦੇ ਵਧਣ ਤੋਂ ਬਾਦ ਉਸ ਬੰਦੇ ਨੇ ਜਿਹੜਾ ਹੈ ਉਹ ਪੂਰਾ ਸਾਈਕਲ ਬਣਾਉਣਾ ਸ਼ੁਰੂ ਕਰ ਦਿੱਤਾ ਤੇ ਹੁਣ ਅੱਜ ਦੀ ਤਰੀਕ ਵਿੱਚ ਉਹ ਜਿਹੜਾ ਬੰਦਾ ਹੈ ਉਹ ਸਿਰਫ ਪੈਡਲ ਜਾਂ ਸੀਟ ਤੱਕ ਸੀਮਤ ਨੀ ਹੈਗਾ ਉਹ ਪੂਰਾ ਪੂਰਾ ਸਾਈਕਲ ਜਿਹੜਾ ਹੈਗਾ ਉਹ ਬਨਾ ਕੇ ਵੇਚ ਰਿਹਾ ਹੈ